ਪੰਜ ਨਵੰਬਰ ਉੱਨੀ ਸੌ ਬਿਆਸੀ ਦੋ ਜਨਵਰੀ ਉੱਨੀ ਸੌ ਇਕਆਸੀ ਅੱਠ ਦਸੰਬਰ ਉੱਨੀ ਸੌ ਬੱਨਵੇ ਸੋਲ੍ਹਾਂ ਮਈ ਉੱਨੀ ਸੌ ਉਨਾਹਟ ਇਕੱਤੀ ਅਕਤੂਬਰ ਉੱਨੀ ਸੌ ਪਚਾਸੀ